ਜਿੱਦਾਂ ਕਿ ਪੰਜਾਬ ਵਿੱਚ ਵੀ ਵਿਆਹਾਂ ਦਾ ਸ਼ੀਜ਼ਨ ਆਉਂਦਾ ਹੈ ਵਿਆਹਾਂ ਦੇ ਮਹੀਨੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਕਿ ਨਾ ਤਾਂ ਬਹੁਤੀ ਸਰਦੀ ਹੁੰਦੀ ਹੈ ਨਾਂ ਬਹੁਤੀ ਗਰਮੀ ਹੁੰਦੀ ਹੈ ਤਕਰੀਬਨ ਵਿਆਹਾਂ ਦੇ ਮਹੀਨੇ ਸ਼ੁਰੂ ਹੋ ਜਾਂਦੇ ਹਨ ਵਿਆਹ ਵਿੱਚ ਜਾਣ ਦਾ ਆਪਣਾ ਹੀ ਚਾਅ ਅਲੱਗ ਹੁੰਦਾ ਹੈ ਜਦੋਂ ਵਿਆਹ ਵਿੱਚ ਜਾਂਦੇ ਹਾਂ ਵਿਆਹ ਵਾਲੇ ਘਰ ਜਾਂਦੇ ਹਾਂ ਪਹਿਲਾਂ ਤਾਂ ਜਾਂਦਿਆਂ ਨੂੰ ਹੀ ਤੇਲ ਚੋਇਆ ਜਾਂਦਾ ਹੈ ਫਿਰ ਸਾਰੇ ਰਿਸ਼ਤੇਦਾਰਾਂ ਨਾਲ ਮਿਲਣੀ ਬਗੈਰਾ ਕੀਤੀ ਜਾਂਦੀ ਹੈ ਇੱਕ ਦੂਜੇ ਨੂੰ ਗਲ ਲੱਗ ਲੱਗ ਕੇ ਮਿਲਦੇ ਹਨ ਬਹੁਤ ਖੁਸ਼ੀ ਹੁੰਦੀ ਹੈ ਅਤੇ ਫਿਰ ਪਕਵਾਨਾਂ ਦੀ ਵਾਰੀ ਆ ਜਾਂਦੀ ਹੈ ਚਾਹ ਪਾਣੀ ਆਉਂਦਾ ਹੈ ਨਵੇਂ ਨਵੇਂ ਪਕਵਾਨ ਬਣਦੇ ਹਨ ਵਿਆਹਾਂ ਵਿੱਚ ਜੋ ਵੀ ਰਿਸ਼ਤੇਦਾਰਾਂ ਨੂੰ ਪਰੋਸੇ ਜਾਂਦੇ ਹਨ ਬਹੁਤ ਵਧੀਆ ਲੱਗਦਾ ਹੈ ਸਾਰਿਆਂ ਦੇ ਮਨ ਵਿੱਚ ਇੱਕ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਹੁੰਦੀ ਹੈ ਫਿਰ ਆਪਣੇ ਸ਼ਾਮ ਟਾਈਮ ਵਿਆਹਾਂ ਵਿੱਚ ਲੇਡੀ ਸੰਗੀਤ ਹੁੰਦਾ ਹੈ ਡੀਜੇ ਬਗੈਰਾ ਚੱਲਦੇ ਨੇ ਅਤੇ ਸ਼ਰਾਬਾਂ ਵੀ ਬੜੀਆਂ ਪੀਤੀਆਂ ਜਾਂਦੀਆਂ ਨੇ ਲੋਕ ਨੱਚਦੇ ਨੇ ਗਾਉਂਦੇ ਨੇ ਮਸਤੀ ਮਨਾਉਂਦੇ ਨੇ ਆਪਣਾ ਰਾਤ ਨੂੰ ਬਾਰਾਂ ਇੱਕ ਵਜੇ ਤੱਕ ਪ੍ਰੋਗਰਾਮ ਚੱਲਦਾ ਹੈ ਉਸ ਤੋਂ ਬਾਅਦ ਸੁਬਹ ਉੱਠ ਕੇ ਸਾਜਰੇ ਆਪਣਾ ਨਹਾ ਧੋ ਕੇ ਸਾਰੇ ਬਰਾਤ ਲਈ ਤਿਆਰ ਹੁੰਦੇ ਨੇ ਆਪੋ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਲੜਕੀ ਘਰ ਜਾਂਦੇ ਨੇ ਲੜਕੀ ਘਰ ਜਾ ਕੇ ਸਭ ਤੋਂ ਪਹਿਲਾਂ ਮਿਲਣੀਆਂ ਦੀ ਰਸਮ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਚਾਹ ਪਾਣੀ ਪੀਤਾ ਜਾਂਦਾ ਹੈ ਚਾਹ ਪਾਣੀ ਤੋਂ ਬਾਅਦ ਅਨੰਦ ਕਾਰਜਾਂ ਦੀ ਰਸਮ ਹੁੰਦੀ ਹੈ ਅਨੰਦ ਕਾਰਜ ਹੁੰਦੇ ਨੇ ਜਿਸ ਵਿੱਚ ਕਿ ਚਾਰ ਲਾਵਾਂ ਲਿੱਤੀਆਂ ਜਾਂਦੀਆਂ ਨੇ ਰਾਗੀ ਸਿੰਘ ਵੀ ਲੱਗੇ ਹੁੰਦੇ ਨੇ ਉਸ ਤੋਂ ਬਾਅਦ ਆਪਣਾ ਲੜਕੀ ਦੀ ਵਿਦਾ ਵਿਦਾਇਗੀ ਹੁੰਦੀ ਹੈ ਘਰਾਂ ਫਿਰ ਸ਼ਾਮ ਟਾਈਮ ਘਰ ਆ ਜਾਂਦੇ ਨੇ ਘਰ ਆ ਕੇ ਸਭ ਫਿਰ ਦੁਬਾਰਾ ਨੱਚਦੇ ਗਾਉਂਦੇ ਨੇ ਅਤੇ ਫਿਰ ਮਾਹੌਲ ਸਭ ਵਧੀਆ ਹੋ ਜਾਂਦਾ ਹੈ